ਮੇਰੀ ਮਨਪਸੰਦ ਕਿਤਾਬ ਔਰਤ ਦੀ ਜ਼ਿੰਦਗੀ ਹੈ ਇਹ ਕਿਤਾਬ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸਾਰੀਆਂ ਕਿਤਾਬਾਂ ਔਰਤ ਦੀ ਜ਼ਿੰਦਗੀ ਬਾਰੇ ਲਿਖੀਆਂ ਪਰ ਮੈਂ ਉਹਨਾਂ ਦੀ ਇਹ ਕਿਤਾਬ ਪੜ੍ਹੀ ਹੈ ਔਰਤ ਦੀ ਜ਼ਿੰਦਗੀ ਪੁਰਾਣੇ ਸਮਾਜ ਵਿੱਚ ਔਰਤ ਦੀ ਜ਼ਿੰਦਗੀ ਬਹੁਤ ਹੀ ਔਰਤ ਦੀ ਜ਼ਿੰਦਗੀ ਬਹੁਤ ਜ਼ਿਆਦਾ ਖ਼ਰਾਬ ਸੀ ਪੁਰਾਣੇ ਜ਼ਮਾਨੇ ਵਿੱਚ ਔਰਤ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਕੀਤਾ ਜਾਂਦਾ ਸੀ ਔਰਤ ਨੂੰ ਆਪਣੀ ਮਰਜ਼ੀ ਨਾਲ ਘੁੰਮਣ ਦੀ ਆਜ਼ਾਦੀ ਨਹੀਂ ਸੀ ਮਰਦ ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ ਅਤੇ ਆਪਣੀ ਮਰਜ਼ੀ ਨਾਲ ਉਸ ਤੋਂ ਕੰਮ ਕਰਵਾਉਂਦਾ ਸੀ ਪੁਰਾਣੇ ਜ਼ਮਾਨੇ ਵਿੱਚ ਔਰਤ ਆਪਣੇ ਫੇਸ ਕਵਰ ਕਰਕੇ ਘੁੰਡ ਕੱਢ ਕੇ ਕੋਈ ਵੀ ਕੰਮ ਕਰਦੀ ਸੀ ਉਹ ਆਪਣਾ ਫੇਸ ਵੀ ਸਭ ਨੂੰ ਨਹੀਂ ਦਿਖਾਉਂਦੀ ਸੀ ਉਹ ਆਪਣੇ ਘਰ ਵਾਲੇ ਦੇ ਸਾਹਮਣੇ ਹੀ ਆਪਣੀ ਚੁੰਨੀ ਉੱਪਰ ਚੱਕ ਸਕਦੀ ਸੀ ਇਸ ਤਰ੍ਹਾਂ ਉਸ ਨੂੰ ਕੰਮ ਕਰਨ ਵਿੱਚ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਸਨ ਔਰਤ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਖਰੀਦ ਨਹੀਂ ਸਕਦੀ ਸੀ ਅਤੇ ਨਾ ਹੀ ਔਰਤ ਨੂੰ ਪੜ੍ਹਾਈ ਦਾ ਅਧਿਕਾਰ ਦਿੱਤਾ ਗਿਆ ਸੀ ਜੇਕਰ ਕੋਈ ਔਰਤ ਪੜ੍ਹਨਾ ਚਾਹੁੰਦੀ ਸੀ ਤਾਂ ਉਸ ਨੂੰ ਰੋਕ ਦਿੱਤਾ ਜਾਂਦਾ ਸੀ ਉਸ ਨੂੰ ਪੜ੍ਹਨ ਦੀ ਆਜ਼ਾਦੀ ਨਹੀਂ ਸੀ ਅਤੇ ਨਾ ਹੀ ਉਹ ਵੋਟ ਪਾ ਸਕਦੀ ਸੀ ਇਹ ਵੋਟ ਪਾਉਣ ਦਾ ਅਧਿਕਾਰ ਵੀ ਔਰਤ ਨੂੰ ਨਹੀਂ ਸੀ ਪੁਰਾਣੇ ਜ਼ਮਾਨੇ ਵਿੱਚ ਔਰਤ 'ਤੇ ਬਹੁਤ ਅੱਤਿਆਚਾਰ ਕੀਤਾ ਜਾਂਦਾ ਸੀ ਛੋਟੀ ਹੀ ਉਮਰ ਵਿੱਚ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਅਤੇ ਫਿਰ ਉਸ ਦਾ ਘਰਵਾਲਾ ਉਸ ਨੂੰ ਸ਼ਰਾਬੀ ਮਿਲ ਜਾਂਦਾ ਸੀ ਤਾਂ ਉਹ ਉਸ 'ਤੇ ਬਹੁਤ ਅੱਤਿਆਚਾਰ ਕਰਦਾ ਸੀ ਉਹ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ ਅਤੇ ਉਹ ਕੁਛ ਵੀ ਨਹੀਂ ਕਰ ਸਕਦੀ ਸੀ ਉਸ ਕੋਲ ਕੋਈ ਵੀ ਅਧਿਕਾਰ ਨਹੀਂ ਸੀ ਉਹ ਡਰਦੀ ਹੋਈ ਆਪਣੇ ਮਨ ਵਿੱਚ ਹੀ ਸਭ ਗੱਲਾਂ ਰੱਖ ਲੈਂਦੀ ਸੀ ਉਹ ਆਪਣੇ ਪੇਕੇ ਘਰ ਵਿੱਚ ਵੀ ਕੁਝ ਨਹੀਂ ਦੱਸਦੀ ਸੀ ਅਤੇ ਹੁਣ ਔਰਤ ਦੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆ ਗਿਆ ਹੈ ਉਹ ਵੋਟਾਂ ਲੜ ਸਕਦੀ ਹੈ ਉਹ ਵੋਟਾਂ ਪਾ ਸਕਦੀ ਹੈ ਚੋਣਾਂ ਲੜ ਸਕਦੀ ਹੈ ਔਰਤ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਜਿਵੇਂ ਜਿਵੇਂ ਔਰਤਾਂ ਨੇ ਪੜ੍ਹਾਈ ਸ਼ੁਰੂ ਕੀਤੀ ਹੈ ਉਹ ਪਹਿਲੇ ਨੰਬਰ 'ਤੇ ਆ ਰਹੀ ਹੈ ਮਰਦ ਨਾਲੋਂ ਕਾਫੀ ਅੱਗੇ ਜਾ ਰਹੀ ਹੈ ਔਰਤ ਆਪਣੇ ਅਧਿਕਾਰ ਪ੍ਰਾਪਤ ਕਰ ਰਹੀ ਆ ਉਹ ਖੁਦ ਲਈ ਲੜ ਰਹੀ ਹੈ ਅਤੇ ਹਰ ਇੱਕ ਔਰਤ ਨੂੰ ਆਪਣੇ ਲਈ ਲੜਨਾ ਚਾਹੀਦਾ ਹੈ ਬੋਲਣਾ ਚਾਹੀਦਾ ਹੈ ਆਪਣੇ ਅਧਿਕਾਰ ਪ੍ਰਾਪਤ ਕਰਨੇ ਚਾਹੀਦੇ ਹਨ ਹਰੇਕ ਔਰਤ ਨੂੰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਕਾ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਅੱਜ ਉਹ ਇਹ ਅਧਿਕਾਰ ਪ੍ਰਾਪਤ ਕਰ ਰਹੀ ਹੈ ਔਰਤ ਮਰਦ ਨਾਲੋਂ ਬਹੁਤ ਅੱਗੇ ਜਾ ਰਹੀ ਹੈ